ਮੈਂ ਆਪਣੇ ਰਿਹਾਇਸ਼ੀ ਸ਼ਹਿਰ ਤੋਂ ਬਾਹਰ ਜਾ ਰਿਹਾ ਹਾਂ ਜਾਂ ਕੁਛ ਸਮੇਂ ਲਈ ਉੱਥੇ ਹੀ ਰਹਿਣਾ ਹੈ ਮੇਰਾ ਆਪਣੇ ਰਿਹਾਇਸ਼ੀ ਏਰੀਏ ਵਿੱਚ

ਕੰਪਨੀ

ਸਲੰਡਰ ਗੈਸ

ਦੂਸਰੇ ਸਥਾਨ 'ਤੇ ਕਿਸੇ ਹੋਰ ਕੰਪਨੀ ਦਾ ਸਿਲੰਡਰ ਬੁਕਿੰਗ ਦਫਤਰ ਹੈ ਜਿੰਨ੍ਹਾਂ

ਸਰਵਿਸ ਬਹੁਤ ਵਧੀਆ ਹੈ ਮੇਰਾ ਮਨ ਬਣ ਗਿਆ ਹੈ ਕਿ ਮੈਂ ਉਹਨਾਂ ਤੋਂ ਕਨੈਕਸ਼ਨ ਲਵਾਂ ਮੌਜੂਦਾ ਸਮੇਂ ਵਿੱਚ ਮੈਂ ਵੱਖਰੇ ਸ਼ਹਿਰ ਵਿੱਚ ਸੇਮ ਕੰਪਨੀ ਦੀ ਬਜਾਏ ਦੂਸਰੀ ਕੰਪਨੀ ਦਾ ਸਲੰਡਰ ਲਵਾਂ ਜਿਸ ਦੀ ਪਹੁੰਚ ਬਹੁਤ ਵਧੀਆ ਹੈ ਅਤੇ ਅਤੇ ਜਿਸ ਦੀ ਸਰਵਿਸ ਬਹੁਤ ਚੰਗੀ ਹੈ ਜਿਸ ਦੀ ਕਸਟਮਰ ਨੰਬਰ 'ਤੇ ਸਾਡਾ ਪੂਰਾ ਕਾਲ ਕਰਨ 'ਤੇ ਧਿਆਨ ਰੱਖਿਆ ਜਾਂਦਾ ਹੈ ਸਾਨੂੰ ਹਰ ਤਰ੍ਹਾਂ ਦੀ ਸੁਵਿਧਾ ਪ੍ਰਦਾਨ ਕੀਤੀ ਜਾਂਦੀ ਹੈ ਇਸ ਲਈ ਪਰ ਮੈਂ ਪਹਿਲਾਂ ਵੀ ਆਪਣੀ ਪੁਰਾਣੀ ਕੰਪਨੀ ਦਾ ਸਿਲੰਡਰ ਬੁੱਕ ਕਰ ਚੁੱਕਾ ਹਾਂ ਅਤੇ ਮੈਨੂੰ ਮੇਰਾ ਸਲੰਡਰ ਬੁਕਿੰਗ ਕੋਡ ਮਿਲ ਚੁੱਕਾ ਹੈ ਪਰ ਮੈਂ ਨਹੀਂ ਚਾਹੁੰਦਾ ਕਿ ਪੁਰਾਣੀ ਕੰਪਨੀ ਤੋਂ ਸਿਲੰਡਰ ਲਿਆ ਜਾਵੇ ਸੋ ਗੈਸ ਰੱਦ ਕਰਨ ਲਈ ਮੈਂ ਆਪਣੀਆਂ ਕੋਸ਼ਿਸ਼ਾਂ ਕਰਾਂਗਾ ਸਭ ਤੋਂ ਪਹਿਲਾਂ ਮੈਂ ਕਸਟਮਰ ਨੰਬਰ 'ਤੇ ਜਾ ਕੇ ਉਸ ਏਜੰਸੀ ਨੂੰ ਫੋਨ ਕਰਾਂਗਾ ਕਿ ਮੇਰੀ ਬੁਕਿੰਗ ਰੱਦ ਕਰ ਦਿੱਤੀ ਜਾਵੇ ਹੁਣ ਮੈਂ ਸਿਲੰਡਰ ਨਹੀਂ ਲੈਣਾ ਜਾਂ ਮੈਨੂੰ ਨਹੀਂ ਜ਼ਰੂਰਤ ਹੈ ਜੇਕਰ ਉਸ ਮੈਨੂੰ ਕਸਟਮਰ ਨੰਬਰ 'ਤੇ ਸਹੀ ਪ੍ਰਤੀ ਪੁਸ਼ਟੀ ਨਹੀਂ ਕਰਨਗੇ ਤਾਂ ਫਿਰ ਮੈਂ ਉਹਨਾਂ ਦੇ ਕੰਪਨੀ ਦੀ ਉੱਚ ਅਥੋਰਟੀ ਨਾਲ ਸੰਪਰਕ ਕਰਾਂਗਾ ਅਤੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਲੋਕਲ ਏਰੀਏ ਦਾ ਕਸਟਮਰ ਕੇਅਰ ਸੈਂਟਰ ਜਾਂ ਦਫਤਰ ਮੇਰੀ ਗੱਲ ਨੂੰ ਤਵੱਜੋ ਨਹੀਂ ਦੇ ਰਿਹਾ ਸੋ ਉਹਨਾਂ ਨੂੰ ਕਹਿ ਕੇ ਮੈਂ ਉੱਪਰ ਤੋਂ ਆਪਣੀ ਬੁਕਿੰਗ ਰੱਦ ਕਰਵਾਵਾਂਗਾ ਫਿਰ ਵੀ ਜੇਕਰ ਮੇਰਾ ਸਲੰਡਰ ਮੇਰੇ ਘਰ ਪਹੁੰਚ ਜਾਂਦਾ ਹੈ ਤਾਂ ਮੈਂ ਉਸਦੀ ਡਿਲੀਵਰੀ ਨਹੀਂ ਲਵਾਂਗਾ ਅਤੇ ਉਹਨਾਂ ਨਾਲ ਜਾ ਕੇ ਖੁਦ ਜਾ ਕੇ ਗੱਲਬਾਤ ਕਰਾਂਗਾ ਅਤੇ ਆਪਣੀ ਬੁਕਿੰਗ ਰੱਦ ਕਰਵਾਵਾਂਗਾ